ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੀ ਦਲਜੀਤ ਸਿੰਘ ਨਾਲ ਗੱਲ ਹੋ ਰਹੀ ਹੈ ਓਕੇ ਮੈਂ ਨਾ ਤੁਹਾਨੂੰ ਓਕੇ ਮੈਂ ਨਾ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਮੇਲ 'ਤੇ ਆਪਣਾ ਰਜੀਊਮੇ ਭੇਜਿਆ ਸੀਗਾ ਅਤੇ ਮੈਨੂੰ ਨਾ ਜੋਬ ਚਾਹੀਦੀ ਆ ਹਾਂਜੀ ਮੈਂ ਬੀ ਏ ਕਰਦਾ ਰੈਗੁਲਰ ਨਹੀਂ ਹੈਗੀ ਕੋਰਸਪੋਡਸ ਬੀ ਏ ਕਰਦਾਂ ਮੈਂ ਨਾਲ ਮੈਨੂੰ ਜੋਬ ਚਾਹੀਦੀ ਹੈ ਮੈਂ ਫਰੈਸ਼ਰ ਹਾਂ ਹਾਂਜੀ ਨਹੀਂ ਮੈਨੂੰ ਓਕੇ ਓਕੇ ਕੀ ਟਾਈਮਿੰਗ ਹੈ ਔਫਿਸ ਦੀ ਤੁਹਾਡੀ ਓਕੇ ਅਤੇ ਤੁਸੀਂ ਉੱਥੇ ਹੁੰਦੇ ਹੋ ਜਾਂ ਤੁਹਾਡੇ ਵਰਕਰ ਹੀ ਹੁੰਦੇ ਆ ਉੱਥੇ ਓਕੇ ਓਕੇ ਅਤੇ ਫਿਰ ਕੋਈ ਨਾ ਮੈਂ ਠੀਕ ਹੈ ਆਊਗਾ ਕੱਲ੍ਹ ਨੂੰ ਮੈਂ ਆ ਜਾਵਾਂਗਾ ਦਸ ਜਾਂ ਗਿਆਰ੍ਹਾਂ ਵਜੇ ਦੇ ਵਿੱਚ ਵਿੱਚ ਓਕੇ ਹਾਂਜੀ ਹਾਂ ਮੈਨੂੰ ਨਾ ਮੋਹਾਲੀ ਏਰੀਏ 'ਚ ਮਿਲ ਜੇ ਤਾਂ ਬੈਟਰ ਹੈ ਓਕੇ ਜੀ ਓਕੇ ਚਲੋ ਥੈਂਕਯੂ ਸਰ